ਮਨੋਰੰਜਨ ਦਾ ਮੇਨ ਉਰੇ ਹੁਣ ਪੰਜਾਬ 'ਚ ਖੇਡਾਂ ਚੱਲ ਰਹੀਆਂ ਹਨ ਜਿਹੜੇ ਹਰੇਕ ਜ਼ਿਲ੍ਹੇ ਵਿੱਚ ਵੱਡੇ ਪੱਧਰ 'ਤੇ ਕਰਾਈਆਂ ਜਾ ਰਹੀਆਂ ਹਨ ਮੇਨ ਖੇਡ ਪੰਜਾਬ ਦੀ ਹੋਕੀ ਕਬੱਡੀ ਅਤੇ ਫੁੱਟਬਾਲ ਹੈ ਜਿਹੜੇ ਸਾਰੇ ਹੀ ਜ਼ਿਲ੍ਹਿਆ ਵਿੱਚ ਟੋਪ ਦੇ ਖਿਡਾਰੀ ਲੈ ਕੇ ਉਹਨਾਂ ਨਾਲ ਜ਼ਿਲ੍ਹੇ ਲੇਵਲ 'ਤੇ ਅਤੇ ਰਾਜ ਲੇਵਲ 'ਤੇ ਮੁਕਾਬਲੇ ਕਰਾਏ ਜਾ ਰਹੇ ਹਨ ਇਹਦੇ ਵਿੱਚ ਸਾਰੇ ਹੀ ਸਕੂਲਾਂ ਦੇ ਕੋਲਜਾਂ ਦੇ ਬੱਚੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲੇ ਰਹੇ ਹਨ ਅਤੇ ਤੁਸੀਂ ਉਰੇ ਆ ਕੇ ਇਹ ਖੇਡਾਂ ਰਾਹੀਂ ਪੰਜਾਬ ਦੇ ਲੋਕਾਂ ਦਾ ਉਤਸ਼ਾਹ ਦੇਖ ਸਕਦੇ ਹੋ ਪੰਜਾਬ ਵਿੱਚ ਖੇਡਾਂ ਦਾ ਇਸ ਸਮੇਂ ਪੂਰਾ ਜ਼ੋਰ ਚੱਲ ਰਿਹਾ ਹੈ